ਹੈਲੋ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਓਂ ਤੁਸੀਂ ਮੈਂ ਵੀ ਵਧੀਆ ਮੈਮ ਨਹੀਂ ਨਹੀਂ ਮੈਮ ਹਜੇ ਤਾਂ ਨਹੀਂ ਆਈ ਵੈਸੇ ਇੱਕ ਦੋ ਮਹੀਨਿਆਂ ਤੱਕ ਆ ਜਾਣੀ ਹੈ ਕੀ ਹੋਇਆ ਕਿਹਨੇ ਐਡਮੀਸ਼ਨ ਲੈਣੀ ਹੈ ਠੀਕ ਹੈ ਠੀਕ ਹੈ ਪ੍ਰੀ ਨਰਸਰੀ 'ਚ ਲਗਾਉਣੀ ਹੈ ਤੁਸੀਂ ਆਪਣੀ ਬੇਟੀ ਹੁਣ ਠੀਕ ਹੈ ਮੈਮ ਮੇਰੀ ਵੀ ਬੇਟੀ ਸ਼ਿਵਾਲਿਕ 'ਚ ਹੀ ਪੜ੍ਹੀ ਹੈ ਸ਼ੁਰੂ ਤੋਂ ਸੱਚੀ ਸਕੂਲ ਤਾਂ ਬਹੁਤ ਵਧੀਆ ਹੈ ਫ਼ੀਸ ਵਗੈਰਾ ਵੀ ਕਾਫ਼ੀ ਸਹੀ ਹੈ ਐਨੁਅਲ ਐਨੁਅਲ ਸਾਡੇ ਚਾਰਜਿਜ਼ ਜਿਹੜੇ ਨੇ ਉਹ ਟਵੰਟੀ ਥਾਊਜ਼ੈਂਡ ਤੱਕ ਚਲ ਜਾਂਦੇ ਨੇੇ ਮੈਮ ਬਾਕੀ ਬੁੱਕਸ ਵਗੈਰਾ ਦਾ ਥੋੜ੍ਹਾ ਜਿਹਾ ਖ਼ਰਚਾ ਹੁੰਦਾ ਹੈ ਕਾਫ਼ੀ ਸਹੀ ਹੈ ਬਾਕੀ ਦੇਖੋ ਮੈਮ ਸਕੂਲ ਤਾਂ ਸਾਰੇ ਹੀ ਵਧੀਆ ਹੁੰਦੇ ਆ ਇਹ ਤਾਂ ਆਪਣੀ ਚੋਆਇਸ ਆ ਹੁਣ ਕਿਹੜੇ ਸਕੂਲ 'ਚ ਲਗਾਉਣਾ ਏ ਕਿਹੜੇ 'ਚ ਨਹੀਂ ਤੁਸੀਂ ਪਤਾ ਕਰ ਸਕਦੇ ਹੋ ਹਰੇਕ ਸਕੂਲ 'ਚ ਬਾਕੀ ਇੰਨਕੁਆਰੀ ਵਗੈਰਾ ਕਰ ਸਕਦੇ ਹੋ ਮੇਰੇ ਅਕੋਰਡਿੰਗ ਤਾਂ ਸ਼ਿਵਾਲਿਕ ਵਧੀਆ ਹੈ ਫ਼ੀਸ ਦੇ ਅਕੋਰਡਿੰਗ ਵੀ ਅਤੇ ਬਾਕੀ ਸਟੱਡੀ ਵੀ ਅਤੇ ਕੋ ਕਰਿਕੁਲਰ ਐਕਟੀਵੀਟੀਜ਼ ਵੀ ਸਾਰਾ ਕੁਝ ਵਧੀਆ ਹੁੰਦਾ ਹੈ ਇੱਥੇ ਹਾਂਜੀ ਹਾਂਜੀ ਮੈਮ ਚਲੋ ਜਦੋਂ ਵੀ ਐਡਮੀਸ਼ਨ ਦਾ ਨੋਟਿਸ ਆਵੇਗਾ ਨਾ ਮੈਂ ਤੁਹਾਨੂੰ ਦੱਸ ਦੇਵਾਂਗੀ ਠੀਕ ਹੈ ਹਾਂਜੀ ਮੈਮ ਸਭ ਠੀਕ ਹੈ ਤੁਸੀਂ ਦੱਸੋ ਹਾਂਜੀ ਬਾਏ ਮੈਮ